ਜ਼ਿਲ੍ਹੇ ਮੋਹਾਲੀ ਵਿੱਚ ਰਿਹਾਇਸ਼ੀ ਵਿਕਲਪ ਦੇ ਨਾਲ ਨਾਲ ਸ਼ਾਪਿੰਗ ਮਾਲਾਂ ਅਤੇ ਦੁਕਾਨਾਂ ਬਹੁਤ ਹਨ ਜਿਨ੍ਹਾਂ ਤੋਂ ਤੁਸੀਂ ਹਰ ਜ਼ਰੂਰਤ ਦੀ ਚੀਜ਼ਾਂ ਜਿਵੇਂ ਕੱਪੜੇ ਖਾਣ ਪੀਣ ਅਤੇ ਹੋਰ ਲੋਂੜੀਦੀਆਂ ਵਸਤਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਇੱਥੇ ਹੋਰ ਸਟੇਟ ਤੋਂ ਲੋਕਾਂ ਨੇ ਆ ਕੇ ਆਪਣੀ ਰੀਅਲ ਸਟੇਟ ਵਿੱਚ ਕੰਮ ਕੀਤਾ ਹੈ ਕਿਉਂਕਿ ਇੱਥੇ ਜ਼ਮੀਨਾਂ ਵਧੀਆ ਅਤੇ ਸਸਤੀਆਂ ਮਿਲ ਜਾਂਦੀਆਂ ਹਨ ਅਤੇ ਇਸ ਦੇ ਨਾਲ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਹਨ ਪ੍ਰਾਪਰਟੀ ਦੀ ਖਰੀਦ ਅਤੇ ਵੇਚ ਨੇ ਜ਼ਿਲ੍ਹੇ ਦੇ ਵਿਕਾਸ ਵਿੱਚ ਬਹੁਤ ਮਦਦ ਕੀਤੀ ਹੈ ਇੱਥੇ ਛੋਟੇ ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਬਹੁਤ ਘੱਟ ਹਨ ਇੱਥੇ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਬਹੁਤ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਹੈ ਇੱਥੇ ਨੌਕ ਲੋੜਵੰਦਾਂ ਲਈ ਨੌਕਰੀਆਂ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ ਇੱਥੇ ਦੂਰੋਂ ਦੂਰੋਂ ਲੋਕ ਆ ਕੇ ਆਪਣੀ ਨੌਕਰੀ ਦੇ ਨਾਲ ਆਪਣਾ ਘਰ ਪਰਿਵਾਰ ਚਲਾਉਂਦੇ ਹਨ